ਭਾਰਤ ਵਿੱਚ ਦੋ ਤਰ੍ਹਾਂ ਦਾ ਭੋਜਨ ਵਰਤਿਆ ਜਾਂਦਾ ਹੈ ਜਿਵੇਂ ਕਿ ਮਾਸਾਹਾਰੀ ਅਤੇ ਸ਼ਾਕਾਹਾਰੀ ਭਾਰਤ ਵਿੱਚ ਜਿਹੜੇ ਇਲਾਕੇ ਸਮੁੰਦਰ ਦੇ ਨੇੜੇ ਹਨ ਉੱਥੇ ਜ਼ਿਆਦਾਤਰ ਮਾਸਾਹਾਰੀ ਭੋਜਨ ਹੀ ਵਰਤਿਆ ਜਾਂਦਾ ਹੈ ਅਤੇ ਜਿਹੜੇ ਇਲਾਕੇ ਠੰਡੇ ਨੇ ਉੱਥੇ ਵੀ ਜ਼ਿਆਦਾਤਰ ਮਾਸਾਹਾਰੀ ਭੋਜਨ ਹੀ ਵਰਤਿਆ ਜਾਂਦਾ ਹੈ ਅਤੇ ਜਿਹੜੇ ਮੈਦਾਨੀ ਇਲਾਕੇ ਨੇ ਜਿਵੇਂ ਕਿ ਪੰਜਾਬ ਹਰਿਆਣਾ ਉੱਥੇ ਜ਼ਿਆਦਾਤਰ ਦੋਨੋਂ ਤਰ੍ਹਾਂ ਦਾ ਹੀ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ ਭਾਵ ਕਿ ਮਾਸਾਹਾਰੀ ਵੀ ਅਤੇ ਸ਼ਾਕਾਹਾਰੀ ਵੀ ਅਤੇ ਪੰਜਾਬ ਦੇ ਵਿੱਚ ਗਰਮੀ ਅਤੇ ਸਰਦੀ ਦੀਆਂ ਫਸਲਾਂ ਵੀ ਵੱਖਰੀਆਂ ਵੱਖਰੀਆਂ ਨੇ ਜਿਵੇਂ ਕਿ ਗਰਮੀ ਦੇ ਵਿੱਚ ਘੀਆ ਤੋਰੀਆਂ ਭਿੰਡੀ ਅਤੇ ਇਸ ਤਰ੍ਹਾਂ ਦੀਆਂ ਸਬਜ਼ੀਆਂ ਦੀ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ ਅਤੇ ਸਰਦੀਆਂ ਦੇ ਵਿੱਚ ਜਿਵੇਂ ਕਿ ਗੋਭੀ ਗਾਜਰ ਮੂਲੀਆਂ ਸਾਗ ਇਹਨਾਂ ਸਬਜ਼ੀਆਂ ਦਾ ਸੇਵਨ ਵੱਧ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦਾ ਵਧੀਆ ਪਕਵਾਨ ਖੀਰ ਹੈ ਜਿਸ ਨੂੰ ਕਿ ਬਣਾਉਣਾ ਵੀ ਸੌਖਾ ਹੈ ਅਤੇ ਇਹ ਆਪਣਾ ਪੋਸ਼ਟਿਕ ਤੌਰ 'ਤੇ ਵੀ ਬਹੁਤ ਵਧੀਆ ਹੈ ਅਤੇ ਇਸ ਨੂੰ ਖੀਰ ਨੂੰ ਬਣਾਉਣਾ ਬੜਾ ਸੌਖਾ ਹੈ ਚੌਲਾਂ ਦੇ ਵਿੱਚ ਦੁੱਧ ਪਾ ਕੇ ਇਸ ਨੂੰ ਪਹਿਲਾਂ ਰਿੰਨਿਆ ਜਾਂਦਾ ਹੈ ਫਿਰ ਇਸ ਵਿੱਚ ਮਿੱਠਾ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਹੀ ਪੋਸ਼ਟਿਕ ਭੋਜਨ ਵੀ ਮੰਨਿਆ ਜਾਂਦਾ ਹੈ ਇਸਦੇ ਵਿੱਚ ਆਪਾਂ ਡਰਾਈ ਫਰੂਟ ਵੀ ਪਾ ਸਕਦੇ ਹਾਂ ਇਸ ਤੋਂ ਇਲਾਵਾ ਪੰਜਾਬ ਦਾ ਇੱਕ ਹੋਰ ਭੋਜਨ ਵੀ ਬਹੁਤ ਮਸ਼ਹੂਰ ਹੈ ਜਿਵੇਂ ਕਿ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਇਹ ਵੀ ਸ ਸਰਦੀਆਂ ਦੇ ਲਈ ਇੱਕ ਵਰਦਾਨ ਮੰਨਿਆ ਜਾਂਦਾ ਹੈ ਅਤੇ ਸਿਹਤ ਦੇ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਬਹੁਤ ਸਾਰੇ ਮਸਾਲਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਮਸਾਲੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੇ ਨੇ ਜਿਵੇਂ ਕਿ ਸਰਦੀਆਂ ਦੇ ਵਿੱਚ ਗਰਮ ਮਸਾਲਿਆਂ ਦੀ ਵਰਤੋਂ ਕਰ ਕਰਨ ਨਾਲ ਜਿਵੇਂ ਸਰਦੀ ਜ਼ੁਕਾਮ ਬੁਖਾਰ ਤੋਂ ਰਾਹਤ ਮਿਲਦੀ ਹੈ ਅਤੇ ਇਹ ਸਿਹਤ ਦੇ ਲਈ ਵੀ ਬਹੁਤ ਚੰਗੇ ਰਹਿੰਦੇ ਹਨ